ਸਤਿ ਸ਼੍ਰੀ ਅਕਾਲ ਜੀ ਤੁਸੀਂ ਸਰਹਿੰਦ ਟੈਕਸੀ ਸਰਵਿਸ ਵਾਲਿਆਂ ਤੋਂ ਗੱਲ ਕਰਦੇ ਹੋ ਠੀਕ ਹੈ ਜੀ ਮੈਂ ਰਾਜਨਦੀਪ ਕੌਰ ਸਰਹਿੰਦ ਫਤਹਿਗੜ੍ਹ ਸਾਹਿਬ ਤੋਂ ਗੱਲ ਕਰਦੀ ਹਾਂ ਤੁਹਾਡੇ ਨਾਲ ਅਸੀਂ ਜੀ ਪਰਸੋਂ ਫੋਨ ਕੀਤਾ ਸੀਗਾ ਫੋਨ ਕਰਕੇ ਟੈਕਸੀ ਅਸੀਂ ਕਿਰਾਏ 'ਤੇ ਕਰਨ ਲਈ ਜਾਣਾ ਸੀਗਾ ਹੈ ਨਾ ਵੀ ਕੋਲ ਕੀਤੀ ਸੀ ਤੁਹਾਡੇ ਨਾਲ ਤੁਸੀਂ ਸਾਨੂੰ ਟਾਈਮ ਅੱਜ ਦਾ ਫਾਈਨਲ ਕੀਤਾ ਸੀਗਾ ਇੱਕੀ ਤਰੀਕ ਦਾ ਤੁਸੀਂ ਕਹਿ ਰਹੇ ਸੀਗੇ ਵੀ ਸਾਡਾ ਜਿਹੜਾ ਅਸੀਂ ਟਾਈਮ ਅਸੀਂ ਮੋਰਨਿੰਗ ਦਾ ਪੰਜ ਵਜੇ ਦਾ ਟਾਈਮ ਦਿੱਤਾ ਸੀਗਾ ਜਾਣ ਲਈ ਪਰ ਹੁਣ ਅਸੀਂ ਦੇਖੋ ਉਸੇ ਪੁਆਇੰਟ 'ਤੇ ਖੜ੍ਹੇ ਹਾਂ ਤੁਹਾਡਾ ਡਰਾਈਵਰ ਆ ਜਿਹੜਾ ਪੰਜ ਵੱਜ ਕੇ ਪੱਚੀ ਮਿੰਟ ਹੋ ਗਏ ਪੱਚੀ ਮਿੰਟ ਲੇਟ ਆ ਹਾਲੇ ਤੱਕ ਆਇਆ ਨਹੀਂ ਹੈਗਾ ਉਹ ਸਾਨੂੰ ਤਾਂ ਲੱਗਦਾ ਵੀ ਉਹ ਐਨਾ ਲਾਪਰਵਾਹ ਜਿਹੜਾ ਟਾਈਮ ਇੱਕ ਵਾਰ ਦੇ ਤਾ ਉਹ ਉਸ ਉਸ ਟਾਈਮ 'ਤੇ ਕਿਉਂ ਨਹੀਂ ਟਾਈਮ ਨਾਲ ਪਹੁੰਚਿਆ ਤਾਂ ਇਸ ਕਰਕੇ ਸਾਨੂੰ ਜਿਹੜੀ ਇਹ ਤੁਹਾਡੀ ਸਰਵਿਸ ਆ ਸਾਨੂੰ ਇਹ ਨਹੀਂ ਚੰਗੀ ਲੱਗਦੀ ਧੰਨਵਾਦ ਮੈਂ ਆਪਣੀ ਜਿਹੜੀ ਟੈਕਸੀ ਦੀ ਆ ਉਹ ਕੈਂਸਲ ਕਰਵਾਉਣਾ ਚਾਹੁੰਦੀ ਹਾਂ